ਕਲਾ ਅਤੇ ਸ਼ਿਲਪਕਾਰੀ ਇੱਕ ਇਹੋ ਜਿਹੀ ਪ੍ਰਕਿਰਿਆ ਹੈ ਜੋ ਕਿ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਸਿਖਾਈ ਜਾ ਸਕਦੀ ਹੈ ਪਰ ਇੱਕ ਆਮ ਜ਼ਿੰਦਗੀ ਵਿੱਚ ਬੰਦਾ ਸਿੱਖ ਸਕਦਾ ਹੈ ਜਿਸ ਤਰ੍ਹਾਂ ਮੈਂ ਆਪਣੇ ਅਗਰ ਬਚਪਨ ਦੀ ਚੀਜ਼ਾਂ ਯਾਦ ਕਰਾਂ ਅਤੇ ਜਦੋਂ ਵਰਖਾ ਪੈਂਦੀ ਸੀ ਤਾਂ ਹਰ ਬੰਦਾ ਬੱਚਾ ਆਪੇ ਇੱਕ ਨਾਂਵ ਬਣਾ ਲੈਂਦਾ ਸੀ ਉਸ ਵਿੱਚ ਚਲਾਉਣ ਲਈ ਜੋ ਕਿ ਉਹਨੂੰ ਤਾਂ ਲੱਗਦਾ ਸੀ ਇੱਕ ਮਨੋਰੰਜਨ ਦਾ ਸਾਧਨ ਹੈ ਪਰ ਉਹਨੂੰ ਨਹੀਂ ਸੀ ਪਤਾ ਕਿ ਇੱਕ ਕਲਾਕਾਰੀ ਹੈ ਅਤੇ ਸ਼ਿਲਪਕਾਰੀ ਹੈ ਜਿਸ ਦੇ ਨਾਲ ਉਹ ਇੱਕ ਐਸੀ ਚੀਜ਼ ਬਣਾ ਰਿਹਾ ਜੋ ਕਿ ਬਹੁਤ ਮੁਸ਼ਕਿਲ ਬਣਾਉਣੀ ਹੈ ਪਰ ਉਹ ਮਜ਼ੇ ਮਜ਼ੇ ਵਿੱਚ ਮਨੋਰੰਜਨ ਵਿੱਚ ਇਹੋ ਜਿਹੀਆਂ ਚੀਜ਼ਾਂ ਬਣਾ ਕੇ ਖੇਡ ਕੇ ਉਸਨੂੰ ਪਤਾ ਵੀ ਨਹੀਂ ਹੁੰਦਾ ਸੀ ਉਹ ਕੀ ਕਰ ਰਿਹਾ ਸੀ ਇਸੇ ਤਰ੍ਹਾਂ ਜਦੋਂ ਕਲਾਸ ਵਿੱਚ ਉਹ ਬੋਰ ਹੋ ਰਿਹਾ ਹੁੰਦਾ ਸੀ ਤਾਂ ਉਹ ਕੀ ਕਰਦਾ ਸੀ ਕਾਗਜ਼ ਦਾ ਇੱਕ ਰਾਕਟ ਬਣਾ ਕੇ ਉਡਾਉਂਦੇ ਰਹਿੰਦੇ ਸੀ ਉਹ ਸੋਚਦੇ ਸੀ ਕਿ ਇੱਕ ਮਨੋਰੰਜਨ ਹੈ ਸ਼ਰਾਰਤ ਹੈ ਪਰ ਉਹ ਇਹ ਨਹੀਂ ਸੋਚਦੇ ਸੀ ਕਿ ਉਹਦੇ ਅੰਦਰ ਇੱਕ ਕਲਾਕਾਰੀ ਹੈ ਕਲਾ ਹੈ ਜਿਸ ਦਾ ਉਹ ਬਾਹਰ ਕੱਢ ਕੇ ਉਹ ਇਕ ਬਹੁਤ ਵੱਡਾ ਇਸਤੇਮਾਲ ਕਰ ਸਕਦੇ ਹਨ ਇਸ ਵਿੱਚ ਸਕੂਲ ਬੱਚਿਆਂ ਨੂੰ ਦੱਸਦਾ ਹੈ ਕਿ ਇਹ ਜੋ ਤੁਸੀਂ ਕਰ ਰਹੇ ਹੋ ਇਹ ਇੱਕ ਕਲਾਕਾਰੀ ਹੈ ਇੱਕ ਕਲਾ ਹੈ ਸ਼ਿਲਪਕਾਰੀ ਹੈ ਜਿਸਦੀ ਮਦਦ ਨਾਲ ਤੁਸੀਂ ਇੱਕ ਬਹੁਤ ਵੱਡਾ ਗੋਲ ਜਾਂ ਬਹੁਤ ਵੱਧਦੀ ਚੀਜ਼ ਅਚੀਵ ਕਰ ਸਕਦੇ ਹੋ ਆਪਣੀ ਜ਼ਿੰਦਗੀ ਵਿੱਚ ਹਰ ਬੱਚਾ ਆਪਣੀ ਜ਼ਿੰਦਗੀ ਵਿੱਚ ਇਹੋ ਜਿਹੀ ਛੋਟੀ ਮੋਟੀ ਚੀਜ਼ਾਂ ਬਣਾਉਂਦਾ ਰਹਿੰਦਾ ਹੈ ਪਰ ਉਸ ਨੂੰ ਪਤਾ ਨਹੀਂ ਹੁੰਦਾ ਕਿ ਕਿੰਨੀ ਵੱਡੀ ਚੀਜ਼ ਆ ਅਤੇ ਕਿੰਨਾ ਉਹਦੀ ਜ਼ਿੰਦਗੀ ਵਿੱਚ ਵੱਡਾ ਇਮਪੈਕਟ ਪਾ ਸਕਦੀ ਹੈ ਮਤਲਬ ਅਸਰ ਪਾ ਸਕਦੀ ਹੈ ਜਦੋਂ ਇਹ ਪਤਾ ਚੱਲਦਾ ਹੈ ਤਾਂ ਉਹ ਇਸਨੂੰ ਬਹੁਤ ਸੀਰੀਅਸਲੀ ਲੈ ਕੇ ਬਹੁਤ ਵਧੀਆ ਵਧੀਆ ਚੀਜ਼ਾਂ ਬਣਾਉਂਦਾ ਜਿੱਦਾਂ ਕਿ ਹਰ ਇੱਕ ਪੋ ਹਰ ਇੱਕ ਸਮੁੱਚੀ ਚੀਜ਼ ਜਿਹੜੀਆਂ ਅਸੀਂ ਘਰਾਂ ਵਿੱਚ ਯੂਜ ਕਰਦੇ ਹਾਂ ਬਾਹਰ ਯੂਜ ਕਰਦੇ ਹਾਂ ਅਸੀਂ ਸੋਚਦੇ ਹਾਂ ਕਿ ਕਈ ਵਾਰ ਕਿ ਇਹਨਾਂ ਦਾ ਡਿਜਾਇਨਿੰਗ ਇੰਨੀ ਵਧੀਆ ਕਿੱਦਾਂ ਹੈ ਇੰਨਾਂ ਵਧੀਆ ਕਿੱਦਾਂ ਬਣਿਆ ਪਰ ਉਸਦੇ ਪਿੱਛੇ ਵੀ ਕੋਈ ਇਨਸਾਨੀ ਦਿਮਾਗ ਹੀ ਹੁੰਦਾ ਹੈ ਜੋ ਉਸਨੂੰ ਇੰਨੀ ਵਧੀਆ ਚਿਤਰਨ ਦਿੰਦਾ ਹੈ ਜੋ ਕਿ ਦੂਜੇ ਇਨਸਾਨ ਦੇ ਮਨ ਵਿੱਚ ਬੈਠ ਜਾਂਦੀ ਹੈ ਅਤੇ ਸਕੂਲ ਵਿੱਚ ਇਹ ਇੱਕ ਸਬਜੈਕਟ ਦੇ ਵਿਸ਼ੇ ਦੇ ਤੌਰ 'ਤੇ ਪੜ੍ਹਾਇਆ ਜਾਂਦਾ ਜਿਸ ਵਿੱਚ ਬੱਚੇ ਨੂੰ ਦੱਸਿਆ ਜਾਂਦਾ ਹੈ ਕਿ ਇਹਨਾਂ ਨੂੰ ਕਿੰਨੀ ਆਸਾਨੀ ਨਾਲ ਬਣਾਇਆ ਜਾ ਸਕਦਾ ਹੈ ਅੱਜ ਦੇ ਸਮੇਂ ਵਿੱਚ ਤਾਂ ਇਹੋ ਜਿਹੇ ਕਾਲਜ ਵੀ ਖੁ ਸ਼ੁਰੂ ਹੋ ਗਏ ਨੇ ਜਿਹਨਾਂ ਨੂੰ ਆਰਟ ਐਂਡ ਕ੍ਰਾਫਟ ਦੇ ਕਾਲਜ ਦੇ ਨਾਮ ਤੋਂ ਹੀ ਜਾਣਿਆ ਜਾਂਦਾ ਹੈ ਜਿਹਨਾਂ ਵਿੱਚ ਇਹੀ ਚੀਜ਼ਾਂ ਸਿਖਾਈ ਜਾਂਦੀਆਂ ਹਨ ਕਿ ਬੱਚਾ ਕਿੱਦਾਂ ਵੀ ਇਹ ਚੀਜ਼ਾਂ ਬਣਾ ਕੇ ਆਪਣੀ ਜ਼ਿੰਦਗੀ 'ਚ ਰੁਜ਼ਗਾਰ ਪਾ ਸਕਦਾ ਹੈ